ਸਤਿ ਸ਼੍ਰੀ ਅਕਾਲ ਮੈਡਮ ਜੀ ਹੋਰ ਠੀਕ ਠਾਕ ਹੋ ਤੁਸੀਂ ਬਸ ਮੈਡਮ ਜੀ ਮੈਂ ਜਗਬਾਣੀ ਤੋਂ ਬੋਲਦੇ ਹੈ ਜੀ ਅਸੀਂ ਹਾਂਜੀ ਮੈਂ ਅਸੀਂ ਇਹ ਪੁੱਛਣਾ ਚਾਹੁੰਦੇ ਸੀਗੇ ਵਧੀਆ ਜਗਬਾਣੀ ਤੋਂ ਬੋਲਦੇ ਹਾਂ ਇਹ ਪੁੱਛਣਾ ਚਾਹੁੰਦੇ ਆਪਣੇ ਪੰਜਾਬ 'ਚ ਕਿੰਨੀਆਂ ਨਦੀਆਂ ਲੱਗਦੀਆਂ ਕੋਈ ਇਹਨਾਂ ਦੇ ਰੂਟਸ ਬਾਰੇ ਦੱਸੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਹਾਂਜੀ ਹਾਂਜੀ ਅਤੇ ਮੈਮ ਤੁਸੀਂ ਪਾਣੀ ਦਾ ਸ ਬਚਾਓ ਕਿਸ ਤਰ੍ਹਾਂ ਕਰਦੇ ਹੋ ਤੁਸੀਂ ਸਾਨੂੰ ਇਹ ਦੱਸ ਸਕਦੇ ਹੋ ਕਿ ਤੁਹਾਡਾ ਪਾਣੀ ਤੁਹਾਨੂੰ ਸਮੇਂ ਸਿਰ ਮਿਲ ਜਾਂਦਾ ਧੂਤ

ਗੱਲ ਇਹ ਹੈ ਜੀ ਆਪਾਂ ਨੂੰ ਪਾਣੀ ਦੇ ਬਚਾਓ ਕਰ ਲੈਣਾ ਚਾਹੀਦਾ ਪਾਣੀ ਦੀ ਵੱਧ ਤੋਂ ਵੱਧ ਬਚਾਓ ਕਰਨਾ ਚਾਹੀਦਾ ਜੀ

ਹਾਂਜੀ

ਠੀਕ ਹੈ ਜੀ ਚਲੋ ਜੀ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਓਕੇ